ਮੋਹਾਲੀ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰਕ ਤਿਉਹਾਰ ਮਨਾਏ ਜਾਂਦੇ ਹਨ ਕਿਉਂਕਿ ਇੱਥੇ ਹਰ ਇੱਕ ਵਰਗ ਦੇ ਹਰ ਧਰਮ ਦੇ ਨਾਲ਼ ਸੰਬੰਧਿਤ ਵਿਅਕਤੀ ਰਹਿੰਦੇ ਹਨ ਜਿਨਾਂ ਦੀ ਆਪੋ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਹਨ ਅਤੇ ਉਨਾਂ ਦਾ ਇਹਨਾਂ ਵਿੱਚ ਬਹੁਤ ਵਿਸ਼ਵਾਸ ਹੈ ਆਮ ਕਰਕੇ ਦਿਵਾਲੀ ਹਰ ਇੱਕ ਵਰਗ ਨਾਲ਼ ਪਰਿਵਾਰ ਵੱਲੋਂ ਮਨਾਇਆ ਜਾਣ ਵਾਲਾ ਤਿਉਹਾਰ ਹੈ ਅਤੇ ਇਸ ਨੂੰ ਆਪਣੇ ਆਪਣੇ ਤਰੀਕੇ ਅਤੇ ਧਰਮ ਅਨੁਸਾਰ ਮਨਾਇਆ ਜਾਂਦਾ ਹੈ ਹੋਲੀ ਜ਼ਿਆਦਾਤਰ ਹਿੰਦੂ ਸਮਾਜ ਵੱਲੋਂ ਮਨਾਇਆ ਜਾਣ ਵਾਲਾ ਤਿਉਹਾਰ ਹੈ ਪ੍ਰੰਤੂ ਇਸ ਨੂੰ ਹਰ ਇੱਕ ਬੱਚਾ ਚਾਹੇ ਉਹ ਕਿਸੇ ਵੀ ਧਰਮ ਜਾਤ ਨਾਲ਼ ਸੰਬੰਧਿਤ ਬੜੀ ਖੁਸ਼ੀ ਨਾਲ਼ ਰੰਗਾਂ ਨਾਲ਼ ਖੇਡ ਕੇ ਮਨਾਉਂਦੇ ਹਨ ਇਹਨਾ ਇਸ ਤਰ੍ਹਾਂ ਹੀ ਹੋਰ ਤਰ੍ਹਾਂ ਦੇ ਸੱਭਿਆਚਾਰਕ ਤਿਉਹਾਰ ਹਨ ਜਿਨ੍ਹਾਂ ਵਿੱਚ ਲੋਹੜੀ ਦੁਸ਼ਹਿਰਾ ਗਣੇਸ਼ ਪੂਜਾ ਆਦਿ ਸ਼ਾਮਿਲ ਹਨ ਇਹਨਾਂ ਤਿਉਹਾਰਾਂ ਨੂੰ ਲੋਕ ਆਪਣੇ ਖੁਸ਼ੀ ਦੇ ਨਾਲ਼ ਬਹੁਤ ਹੀ ਵਧੀਆ ਤਰੀਕੇ ਨਾਲ਼ ਮੇਲ ਮਿਲਾਪ ਨਾਲ਼ ਮਨਾਉਂਦੇ ਆਉਂਦੇ ਹਨ